ਪੰਜ ਮਾਰਚ ਉੱਨੀ ਅਠੱਤੀ ਦਸ ਜਨਵਰੀ ਵੀਹ ਵੀਹ ਅਠਾਰਾਂ ਮਈ ਉੱਨੀ ਪੰਝੱਤਰ ਸੋਲਾਂ ਅਕਤੂਬਰ ਅਠਾਰਾਂ ਛਿਆਲ਼ੀ ਵੀਹ ਫਰਵਰੀ ਵੀਹ ਇੱਕੀ